ਹਾਂਜੀ ਸਰ ਨਮਸਕਾਰ ਅਸੀਂ ਨਾ ਇੱਧਰ ਆਏ ਸੀਗੇ ਘੁੰਮਣ ਵਾਸਤੇ ਅਤੇ ਤੁਹਾਡਾ ਨੰਬਰ ਮਿਲਿਆ ਕਿਤੋਂ ਮੈਂ ਕਿਹਾ ਚਲੋ ਤੁਹਾਨੂੰ ਪੁੱਛੀਏ ਆਪਣੇ ਪਿੰਡਾਂ ਦੇ ਬਾਰੇ ਕੁਛ ਪੁੱਛਣਾ ਸੀ ਪਿੰਡਾਂ ਦੀ ਲਾਈਫ ਜਿਹੜੀ ਸ਼ਹਿਰਾਂ ਨਾਲੋਂ ਕਿਉਂ ਇੰਨੀ ਵਧੀਆ ਕਿਉਂ ਹੁੰਦੀ ਹੈ ਔਰ ਇੱਥੇ ਥੋੜ੍ਹਾ ਘੁੰਮਣ ਘਾਮਣ ਵਾਸਤੇ ਕਿਹੜੀਆਂ ਕਿਹੜੀਆਂ ਜਗ੍ਹਾ ਨਾ ਤੁਹਾਡੇ ਲਾਗੇ ਛਾਗੇ ਅਤੇ ਸਾਨੂੰ ਦੱਸੋ ਅਸੀਂ ਕਿਉਂਕਿ ਅਸੀਂ ਥੋੜ੍ਹਾ ਦਿਨ ਰਹਿਣਾ ਇੱਥੇ ਸਟੇਅ ਕਰਨਾ ਅਸੀਂ ਥੋੜ੍ਹਾ ਘੁੰਮਣਾ ਚਾਹੁੰਨੇ ਹਾਂ ਹਾਂਜੀ ਹਾਂਜੀ ਹਾਂਜੀ ਹਾਂ ਪਿੰਡ ਕਿਉਂ ਵਧੀ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਜੀ ਜੀ

ਅੱਛਾ ਜੀ ਠੀਕ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਜੀ ਜੀ ਜੀ ਜੀ ਜੀ ਜੀ ਠੀਕ ਠੀਕ ਠੀਕ ਹੈ ਠੀਕ ਹੈ ਠੀਕ ਹੈ ਹਾਂ ਹਾਂ ਹਾਂਜੀ ਉਹ ਵਧੀਆ ਵਧੀਆ ਜੀ ਵਧੀਆ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਠੀਕ ਹੈ ਠੀਕ ਹੈ ਠੀਕ ਹਾਂਜੀ ਜੀ ਜੀ ਜੀ ਜੀ ਜੀ ਜੀ ਬਿਲਕੁਲ ਹਾਂਜੀ ਹਾਂਜੀ ਜੀ ਬਿਲਕੁਲ ਬਿਲਕੁਲ ਬਿਲਕੁਲ ਜੀ ਜੀ ਜੀ ਜੀ ਜੀ ਠੀਕ ਹੈ ਠੀਕ ਹੈ ਸਰ ਮ ਠੀਕ ਹੈ ਅਸੀਂ ਮਾਰਦੇ ਹਾਂ ਚੱਕਰ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਥੈਂਕਸ ਓਕੇ ਓਕੇ ਬਾਏ ਓਕੇ ਠੀਕ ਹੈ ਜੀ